ਹਾਂਜੀ ਮੈਂ ਧਿਆਨ ਅਤੇ ਪ੍ਰਾਣਾਯਾਮ ਕਰ ਲੈਂਦਾ ਹਾਂ ਕਿਉਂਕਿ ਧਿਆਨ ਕਰਨ ਦੇ ਨਾਲ ਸਾਡਾ ਜਿਹੜਾ ਆਪਣਾ ਇਕਾਗਰਤਾ ਜਿਹੜੀ ਹੈਗੀ ਆ ਉਹ ਵੱਧਦੀ ਹੈ ਇਸ ਦੇ ਨਾਲ ਨਾਲ ਪ੍ਰਾਣਾਯਾਮ ਦੇ ਨਾਲ ਸਾਡੇ ਜਿਹੜੇ ਬਲੱਡ ਸਰਕੂਲੇਸ਼ਨ ਹੈਗੇ ਆ ਉਹ ਪ੍ਰੋਪਰ ਕੰਮ ਕਰਦੇ ਰਹਿੰਦੇ ਹਨ ਅਤੇ ਸਾਡੇ ਸਰੀਰ ਨੂੰ ਜਿਹੜੀ ਜ਼ਰੂਰਤ ਮੰਦ ਜਿਹੜੀ ਉਹ ਜਿੰਨੀ ਆਕਸੀਜਨ ਜਿਹੜੇ ਸਾਡੇ ਸਰੀਰ ਉਹ ਲੈ ਲੈਂਦਾ ਆ ਆਪਣੇ ਪ੍ਰਾਣਾਯਾਮ ਕਰਨ ਦੇ ਨਾਲ ਨਾਲ ਨਾਲੇ ਧਿਆਨ ਦੇ ਨਾਲ ਸਾਡੇ ਜਿਹੜੇ ਸਾਰੇ ਆਪਣਾ ਧਿਆਨ ਹੈਗਾ ਜਿਹੜਾ ਉਹ ਇੱਕੋ ਚਾਜ਼ ਇੱਕੋ ਚੀਜ਼ 'ਤੇ ਇੱਕੋ ਟਾਸ 'ਤੇ ਆਪਾਂ ਫੋਕਸ ਕਰਨ ਵਿੱਚ ਮ ਮਦਦ ਕਰਦੇ ਜਿਸ ਦੇ ਨਾਲ ਸਾਡੀ ਇਕਾਗਰਤਾ ਵੱਧਦੀ ਹੈ ਅਤੇ ਇਹ ਸਾਡੇ ਕਿਤੇ ਨਾ ਕਿਤੇ ਕੰਮ ਕਰਨ 'ਚ ਜਾਂ ਸਾਨੂੰ ਕੁਛ ਯਾਦ ਕਰਨ 'ਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ ਅਤੇ ਪ੍ਰਾਣਾਯਾਮ ਦੇ ਨਾਲ ਨਾਲ ਸਾਡੇ ਜਿਹੜੇ ਸਾਹਾਂ 'ਤੇ ਸਾਡਾ ਕੰਟਰੋਲ ਆ ਉਹ ਵੱਧਦਾ ਆ ਜਿਹਦੇ ਨਾਲ ਸਾਡੇ ਕਈ ਬਿਮਾਰੀਆਂ ਜਿਹੜੀਆਂ ਸਾਹ ਦੀਆਂ ਜਾਂ ਦਿਲ ਦੀਆਂ ਹੈਗੀਆਂ ਆ ਉਹ ਦੂਰ ਹੋ ਜਾਂਦੀਆਂ ਹਨ